ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਭੰਗੜੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਹ ਜਿਵੇਂ ਕਿ ਅਸੀਂ ਇਹ ਪੰਜਾਬੀ ਕਿਤੇ ਦੇਸ਼ਾਂ ਵਿਦੇਸ਼ਾਂ ਵਿੱਚ ਕਿਤੇ ਵੀ ਜਾਂਦੇ ਹੈ ਜਿਵੇਂ ਕਿ ਕਨੇਡਾ ਅਮਰੀਕਾ ਕਿਤੇ ਵੀ ਜਾਂਦੇ ਹੈ ਇਹ ਆਪਣੇ ਨਾਲ ਨਾ ਕਈ ਚੀਜ਼ਾਂ ਨਾਲ ਲੈ ਕੇ ਜਾਂਦੇ ਇੱਕ ਪੰਜਾਬੀਆਂ ਵਿੱਚ ਅਲੱਗ ਹੁਨਰ ਹੈ ਜਿੱਦਾਂ ਕਿ ਜਿਵੇਂ ਕਿ ਇਹ ਮੇਨ ਭੰਗੜਾ ਹੋ ਗਿਆ ਜਾਂ ਡਰਾਇਵਰੀ ਹੋ ਗਈ ਜਾਂ ਇਹ ਵਧੀਆ ਕੁਕਿੰਗ ਸਕਿਲ ਇਹ ਬਾਕੀ ਮਕੈਨਿਕ ਇਹ ਸਭ ਤੋਂ ਜ਼ਿਆਦਾ ਮਤਲਬ ਪੰਜਾਬ ਵਿੱਚ ਇਹ ਬੰਦਿਆਂ ਦੀ ਬਹੁਤ ਜ਼ਿਆਦਾ ਸੱਭਿਆਚਾਰ ਨੂੰ ਪ੍ਰਮੋਟ ਕਰਦਾ ਭੰਗੜਾ ਬਾਕੀ ਇਹ ਦੇਖਿਆ ਜਾਵੇ ਕਿ ਇਹ ਜਿੱਦਾਂ ਜਿੱਦਾਂ ਕਿ ਇਹ ਕੋਈ ਵੀ ਫੰਕਸ਼ਨ ਹੁੰਦਾ ਵਿਆਹ ਸ਼ਾਦੀ ਜਾ ਕੋਈ ਰਿਟਾਇਰਮੈਂਟ ਫੰਕਸ਼ਨ ਜਾਂ ਕੁਛ ਵੀ ਹੁੰਦਾ ਤਾਂ ਉਹ 'ਤੇ ਵੀ ਇੱਕ ਜਿਵੇਂ ਕਿ ਵਿਸਾਖੀ ਵਾਲੇ ਦਿਨ ਕਿਸਾਨ ਆਪਣੀ ਇਹ ਫ਼ਸਲ ਲੈ ਕੇ ਇਹ ਸ਼੍ਰੀ ਇਹ ਅਨੰਦਪੁਰ ਸਾਹਿਬ ਜਾਂਦੇ ਹੈ ਇਹ ਸਿੱਖਾਂ ਦਾ ਇਹ ਬਹੁਤ ਜ਼ਿਆਦਾ ਇਹ ਰਿਲੀਜੀਅਸ ਪਲੇਸ ਹੈ ਇੱਥੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰੀ ਸੀਗੀ ਤਾਂ ਵਿਸਾਖੀ ਵਾਲੇ ਦਿਨ ਇਹ ਫ਼ਸਲ ਲੈ ਕੇ ਕਿਸਾਨ ਆਪਣੇ ਉੱਥੇ ਜਾਂਦੇ ਹਨ ਇਹ ਤਾਂ ਉੱਥੇ ਇੱਕ ਬਹੁਤ ਜ਼ਿਆਦਾ ਆਪਣਾ ਇਹ ਭੰਗੜਾ ਖੁਸ਼ੀ ਵਿੱਚ ਵਿਸਾਖੀ ਵਾਲੇ ਦਿਨ ਖੁਸ਼ੀ ਵਿੱਚ ਤਾਂ ਇਹ ਉਸ ਉਹਦੇ ਵਿੱਚ ਜਾ ਕੇ ਭੰਗੜੇ ਨੂੰ ਬਹੁਤ ਖੁਸ਼ੀ ਵਿੱਚ ਭੰਗੜੇ ਨੂੰ ਇਹ ਭੰਗੜਾ ਕਰਦੇ ਜਿਸ ਨਾਲ ਇਹ ਇੱਕ ਤਾਂ ਸਿਹਤ ਤੰਦਰੁਸਤੀ ਦਾ ਇਲਾਜ ਇਹ ਜਿਵੇਂ ਭੰਗੜੇ ਨਾਲ ਸਾਰਾ ਸਾਰੇ ਸਰੀਰ ਦੀ ਮੂਵਮੈਂਟ ਹੁੰਦੀ ਭੰਗੜੇ ਨਾਲ ਜਦੋਂ ਤੱਕ ਭੰਗੜਾ ਨਹੀਂ ਹੁੰਦਾ ਉਦੋਂ ਤੱਕ ਪੰਜਾਬੀ ਖੁਸ਼ੀ ਜਾਹਰ ਨਹੀਂ ਕਰਦੇ ਬਾਕੀ ਇਹ ਪੰਜਾਬ ਦੇ ਤਿਉਹਾਰਾਂ ਵਿੱਚ ਇਸ ਦਾ ਬਹੁਤ ਭੰਗੜੇ ਦਾ ਬਹੁਤ ਜ਼ਿਆਦਾ ਮਹੱਤਵ ਹੈ